ਸਾਡੇ ਖੇਤਰ ਦੇ ਵਿੱਚ ਜ਼ਿਆਦਾਤਰ ਖੇਤੀਬਾੜੀ ਦਾ ਕੰਮ ਹੁੰਦਾ ਹੈ ਜਿਹੜਾ ਸਾਡਾ ਸ਼ਹਿਰ ਤਰਨ ਤਰਨ ਉਰੇ ਆਸ ਪਾਸ ਕਿੰਨੇ ਪਿੰਡ ਇੱਦਾਂ ਦੇ ਹਨ ਜਿੱਥੇ ਖੇਤੀਬਾੜੀ ਹੀ ਜ਼ਿਆਦਾ ਹੁੰਦੀ ਹੈ ਇੱਥੇ ਨਵੇਂ ਨਵੇਂ ਨਿਰਮਾਣ ਨਵੀਂ ਨਵੀਂ ਟੈਕਨੋਲੋਜੀ ਆਈਆਂ ਹੈ ਜਿਹਦੇ ਨਾਲ ਉਹ ਖੇਤੀਬਾੜੀ ਕਰਦੇ ਹਨ ਅਤੇ ਸਾਨੂੰ ਤਾਜ਼ੀਆਂ ਅਤੇ ਪੋਸ਼ਟਿਕ ਸਬਜ਼ੀਆਂ ਪਰਤਾ ਪ੍ਰਾਪਤ ਹੁੰਦੀਆਂ